ਜੀ ਹਾਂ ਮੈਨੂੰ ਭੋਜਨ ਦੇ ਕਈ ਚੀਜ਼ਾਂ ਤੋਂ ਐਲਰਜ਼ੀ ਹੈ ਜਿਹਦੇ ਵਿੱਚ ਕਿ ਅੰਡਾ ਮੁੱਖ ਰੂਪ 'ਚ ਆਉਂਦਾ ਹੈ ਜਿਉਂ ਹੀ ਮੈਂ ਐੱਗ ਨੂੰ ਖਾਂਦੀ ਹਾਂ ਉਹਨੂੰ ਖਾਂਦਿਆਂ ਮੈਨੂੰ ਬੜੀ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਪੇਟ ਦਰਦ ਉਲਟੀਆਂ ਬਹੁਤ ਜ਼ਿਆਦਾ ਮੇਰਾ ਹਾਲ ਬੁਰਾ ਹੋ ਜਾਂਦਾ ਹੈ ਜਦੋਂ ਮੈਂ ਖਾਣਾ ਪਕਾਉਂਦੀ ਹਾਂ ਤਾਂ ਮੈਨੂੰ ਕਈ ਵਾਰੀ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਵੇਂ ਕਿ ਜਿਹੜਾ ਤੇਲ ਸੜਿਆ ਹੋਇਆ ਹੈ ਵੀ ਆ ਪਹਿਲੇ ਉਹਦੇ 'ਚ ਪਕੌੜੇ ਤਲੇ ਹੈ ਉਸ ਤੇਲ ਨੂੰ ਦੁਬਾਰਾ ਨਾ ਵਰਤਾਂ ਕਿਸੇ ਵੀ ਸ ਚੀਜ਼ ਦੇ ਵਿੱਚ ਐੱਗ ਦੀ ਵਰਤੋਂ ਕਰਨੀ ਹੈ ਉਹਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਡਾਲਡਾ ਘਿਓ ਦੀ ਵਰਤੋਂ ਅਸੀਂ ਬਿਲਕੁਲ ਨਹੀਂ ਕਰਦੇ ਨਮਕ ਦੇ ਵਿੱਚ ਮੈਂ ਸੇਂਦਾ ਨਮਕ ਹੀ ਵਰਤਦੀ ਹਾਂ ਅਤੇ ਇਸ ਤਰ੍ਹਾਂ ਸਬਜ਼ੀਆਂ ਕੱਟਣ ਲੱਗੇ ਵੀ ਚੀਜ਼ਾਂ ਦਾ ਧਿਆਨ ਰੱਖਦੀ ਹਾਂ ਕਿ ਉਹਨਾਂ ਦੇ ਵਿੱਚ ਕੋਈ ਕੀੜਾ ਪਤੰਗਾ ਜਾਂ ਕੋਈ ਇਹੋ ਜਿਹੀ ਚੀਜ਼ ਨਾ ਆ ਜਾਵੇ ਜ਼ਿਆਦਾ ਨਮਕ ਖਾਣੇ ਦੇ ਵਿੱਚ ਨਾ ਹੋਵੇ ਇਸ ਚੀਜ਼ ਦਾ ਵੀ ਖਾਸ ਧਿਆਨ ਰੱਖਦੀ ਹਾਂ ਜਿਹਦੇ ਕਰਕੇ ਬੀ ਪੀ ਦੀ ਪ੍ਰੋਬਲਮ ਘਰ ਦੇ ਵਿੱਚ ਕਿਸੇ ਵੀ ਮੈਂਬਰਾਂ ਨੂੰ ਨਾ ਆਵੇ